ਹੈਲੋ ਹੈਲੋ ਮੈਂ ਮੈਨੂੰ ਨਾ ਅਮਨ ਨੇ ਤੁਹਾਡਾ ਨੰਬਰ ਦਿੱਤਾ ਹੈ ਤੁਸੀਂ ਮੈਂ ਨਵਾਂਸ਼ਹਿਰ ਆਉਣਾ ਹੈ ਹਾਂ ਤੁਸੀਂ ਨਵਾਂਸ਼ਹਿਰ ਤੋਂ ਬੋਲ ਰਹੇ ਹੋ ਨਾ ਕੋਈ ਨ ਉੱਥੇ ਜਗ੍ਹਾ ਹੈ ਨਵਾਂਸ਼ਹਿਰ ਵੀ ਵਧੀਆ ਘੁੰਮਣ ਵਾਲੀ ਅੱਛਾ ਫੈਮਿਲੀ ਫੈਮਿਲੀ ਦੇ ਨਾਲ ਆਉਣਾ ਹੈ ਨਾ ਵੀ ਤਾਂ ਵੀ ਵਧੀਆ ਹੋਏ ਕਿਹੜੀ ਕਿਹੜੀ ਜਗ੍ਹਾ ਹੈ ਦੱ ਦੱਸੋ ਕਿਹੜੀ ਕਿਹੜੀ ਜਗ੍ਹਾ ਹੈ ਉੱਥੇ ਦੱਸੋ ਮਾੜੀ ਜੀ

ਅੱਛਾ ਜੀ ਹਮ ਅੱਛਾ ਜੀ ਅੱਛਾ ਜੀ ਅਗਲੇ ਮਹੀਨੇ ਆਈਏ ਜੀ ਕੀ ਦੇਖ ਲਿਓ ਫਿਰ ਤੁਸੀਂ ਆਪਣਾ ਟਾਇਮ ਕੱਢ ਲਿਓ ਠੀਕ ਹੈ ਸੋਲ੍ਹਾਂ ਦਸੰਬਰ ਨੂੰ ਦੇਖਦੇ ਹੈ ਵੀ ਸੋਲ੍ਹਾਂ ਦਸੰਬਰ ਨੂੰ ਆਉਣਾ ਹੈ ਵੀ ਫੈਮਿਲੀ ਦੇ ਨਾਲ ਠੀਕ ਹੈ ਦੋ ਤਿੰਨ ਦਿਨ ਪਹਿਲਾਂ ਤੁਸੀਂ ਮੇ ਮੇਰੀ ਹੋਟਲ ਵੀ ਬੁੱਕ ਕਰਾ ਦਿਓ ਹੈ ਨਾ

ਠੀਕ ਹੈ ਜੀ ਓ ਹੋ ਹੋਟਲ ਦਾ ਨਾਮ ਦੱਸਿਓ ਨਾਮ ਦੱਸਿਓ ਹੋਟਲ ਦਾ ਅੱਛਾ ਜੀ ਠੀਕ ਹੈ ਓਕੇ ਠੀਕ ਹੈ ਵੀਜ਼ਿਟ ਕਰਾਂਗੇ ਅਸੀਂ ਠੀਕ ਹੈ ਹਾਂਜੀ ਠੀਕ ਓਕੇ